ਮੇਰੇ ਅਨੁਸਾਰ ਕਿਰਾਏ ਵਾਲੀਆਂ ਬਾਈਕਾਂ ਦਾ ਚਲਨ ਬਹੁਤ ਵਧੀਆ ਹੈ ਕਿਉਂਕਿ ਅਸੀਂ ਆਪਣੇ ਪਸੰਦ ਮੁਤਾਬਿਕ ਬਾਈਕ ਦਾ ਚੋਇਸ ਕਰ ਸਕਦੇ ਹਾਂ ਜਿਸ ਬਾਈਕ ਦੀ ਸਾਡੀ ਇੱਛਾ ਹੋਵੇ ਕਿਉਂਕਿ ਬਾਈਕ ਨੂੰ ਖਰੀਦਣ ਦੀ ਕੀਮਤ ਦਿਨੋਂ ਦਿਨ ਵਧਦੀ ਜਾ ਰਹੀ ਹੈ ਅਤੇ ਦੂਸਰਾ ਆਪਣੀ ਚੋਇਸ ਦੇ ਮੁਤਾਬਿਕ ਅਸੀਂ ਵੱਖਰੀਆਂ ਵੱਖਰੀਆਂ ਬਾਈਕ ਚਲਾ ਸਕਦੇ ਹਾਂ ਇਹਨਾਂ ਬਾਈਕ ਦੀ ਮੁਰੰਮਤ ਅਤੇ ਸਾਂਭ ਸੰਭਾਲ ਦਾ ਖਰਚਾ ਨਹੀਂ ਹੁੰਦਾ ਇਸ ਨਾਲ ਸਾਡੇ ਪੈਸੇ ਦੀ ਬਚਤ ਹੁੰਦੀ ਹੈ ਦੂਜਾ ਕਿਸੇ ਵੀ ਸ਼ਹਿਰ ਵਿੱਚ ਅਸੀਂ ਆਪਣੀ ਚੋਇਸ ਨਾਲ ਬਾਈਕ ਚਲਾ ਸਕਦੇ ਹਾਂ ਅਤੇ ਪਹੁੰਚ ਸਕਦੇ ਹਾਂ ਇਸ ਨਾਲ ਸਾਡਾ ਸਮਾਂ ਵੀ ਬਚਦਾ ਹੈ ਕਿਰਾਏ ਵਾਲੀ ਬਾਈਕ ਦੇ ਅਸੀਂ ਸਵੈ ਚਾਲਕ ਹੁੰਦੇ ਹਾਂ ਆਪਣੇ ਲੋੜ ਮੁਤਾਬਿਕ ਜਿਸ ਤਰ੍ਹਾਂ ਮਰਜ਼ੀ ਅਤੇ ਕਿਸੇ ਵੀ ਵੇਲੇ ਜਾ ਸਕਦੇ ਹਾਂ ਇਸ ਤਰ੍ਹਾਂ ਦੀ ਬਾਈਕ ਸ਼ਹਿਰ ਵਿੱਚ ਟਰੈਫਿਕ ਨੂੰ ਕਟਾਉਣ ਹ ਕਢਾਉਂਦੀ ਹਨ ਕਿਤੇ ਵੀ ਅਤੇ ਸ਼ਾਂਤ ਵਾਤਾਵਰਨ ਬਣਾਉਂਦੀ ਹੈ